ਮਨੋਰੰਜਨ ਦਾ ਇੱਕ ਮਹੱਤਵਪੂਰਨ ਪਹਿਲੂ ਦਰਸ਼ਕ ਹੈ ਜੋ ਇੱਕ ਨਿੱਜੀ ਮਨੋਰੰਜਨ ਜਾਂ ਮਨੋਰੰਜਨ ਗਤੀਵਿਧੀ ਨੂੰ ਮਨੋਰੰਜਨ ਵਿੱਚ ਬਦਲ ਦਿੰਦਾ ਹੈ ਦਰਸ਼ਕਾਂ ਦੀ ਪੈਸਿਵ ਭੂਮਿਕਾ ਹੋ ਸਕਦੀ ਹੈ ਜਿਵੇਂ ਕਿ ਇੱਕ ਨਾਟਕ ਉਪੇਰਾ ਟੈਲੀਵਿਜ਼ਨ ਸ਼ੋਅ ਜਾਂ ਫਿਲਮ ਦੇਖਦੇ ਹਾਂ ਜਾਂ ਦਰਸ਼ਕਾਂ ਦੀ ਭੂਮਿਕਾ ਸਰਗਰਮ ਹੋ ਸਕਦੀ ਹੈ ਜਿਵੇਂ ਕਿ ਖੇਡਾਂ ਦੇ ਮਾਮਲੇ ਵਿੱਚ ਜਿੱਥੇ ਭਾਗੀਦਾਰ ਅਤੇ ਦਰਸ਼ਕਾਂ ਦੀ ਭੂਮਿਕਾਵਾਂ ਨਿਯਮਿਤ ਤੌਰ 'ਤੇ ਉਲਟ ਹੋ ਸਕਦੀਆਂ ਹਨ ਮਨੋਰੰਜਨ ਜਨਤਕ ਜਾਂ ਨਿੱਜੀ ਹੋ ਸਕਦਾ ਹੈ ਜਿਸ ਵਿੱਚ ਰਸਮੀ ਸਕ੍ਰਿਪਟਡ ਪ੍ਰਦਰਸ਼ਨ ਸ਼ਾਮਿਲ ਹੁੰਦੇ ਹਨ ਜਿਵੇਂ ਕਿ ਥੀਏਟਰ ਜਾਂ ਸੰਗੀਤ ਸਮਾਰੋਹ ਦੇ ਮਾਮਲੇ ਵਿੱਚ ਜਾਂ ਗੈਰ ਸਕ੍ਰਿਪਟ ਅਤੇ ਸਵੈਚਾਲਿਤ ਜਿਵੇਂ ਕਿ ਬੱਚਿਆਂ ਦੀਆਂ ਖੇਡਾਂ ਦੇ ਮਾਮਲੇ ਵਿੱਚ ਮਨੋਰੰਜਨ ਦੇ ਬਹੁਤੇ ਰੂਪ ਕਈ ਸਦੀਆਂ ਤੱਕ ਕਾਇਮ ਰਹੇ ਹਨ ਸੱਭਿਆਚਾਰ ਟੈਕਨੋਲੋਜੀ ਅਤੇ ਫੈਸ਼ਨ ਵਿੱਚ ਤਬਦੀਲੀਆਂ ਦੇ ਕਾਰਨ ਜਿਵੇਂ ਕਿ ਸਟੇਜ ਜਾਦੂ ਦੇ ਨਾਲ਼ ਫਿਲਮਾਂ ਅਤੇ ਵੀਡੀਓ ਗੇਮਾਂ ਹਾਲਾਂਕਿ ਉਹ ਨਵੇਂ ਮਾਧਿਅਮ ਦੀ ਵਰਤੋਂ ਕਰਦੇ ਹਨ ਕਹਾਣੀਆਂ ਸੁਣਾਉਂਦੇ ਹਨ ਨਾਟਕ ਪੇਸ਼ ਕਰਦੇ ਹਨ ਅਤੇ ਸੰਗੀਤ ਚਲਾਉਂਦੇ ਹਨ ਸੰਗੀਤ ਫਿਲਮ ਜਾਂ ਡਾਂਸ ਨੂੰ ਸਮਰਪਿਤ ਤਿਉਹਾਰ ਲਗਾਤਾਰ ਕਈ ਦਿਨਾਂ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਇਜਾਜ਼ਤ ਦਿੰਦੇ ਹਨ ਕੁਝ ਮਨੋਰੰਜਨ ਜਿਵੇਂ ਕਿ ਜਨਤਕ ਫਾਂਸੀ ਹੁਣ ਜ਼ਿਆਦਾਤਰ ਦੇਸ਼ਾਂ ਵਿੱਚ ਗੈਰ ਕਾਨੂੰਨੀ ਹੈ ਫੈਂਸਿੰਗ ਜਾਂ ਤੀਰਅੰਦਾਜ਼ੀ ਵਰਗੀਆਂ ਗਤੀਵਿਧੀਆਂ ਜੋ ਇੱਕ ਵਾਰ ਸ਼ਿਕਾਰ ਜਾਂ ਯੁੱਧ ਵਿੱਚ ਵਰਤੀਆਂ ਜਾਂਦੀਆਂ ਸਨ ਦਰਸ਼ਕਾਂ ਦੀਆਂ ਖੇਡਾਂ ਬਣ ਗਈਆਂ ਹਨ ਇਸ ਤਰ੍ਹਾਂ ਹੋਰ ਗਤੀਵਿਧੀਆਂ ਜਿਵੇਂ ਕਿ ਖਾਣਾ ਪਕਾਉਣਾ ਪੇਸ਼ੇਵਰਾਂ ਦੇ ਪ੍ਰਦਰਸ਼ਨ ਵਿੱਚ ਵਿਕਸਿਤ ਹੋਇਆ ਹੈ ਗਲੋਬਲ ਮੁਕਾਬਲਿਆਂ ਦੇ ਰੂਪ ਵਿੱਚ ਮੰਚਨ ਕੀਤਾ ਗਿਆ ਹੈ ਅਤੇ ਫਿਰ ਮਨੋਰੰਜਨ ਲਈ ਪ੍ਰਸਾਰਿਤ ਕੀਤਾ ਗਿਆ ਹੈ ਇੱਕ ਸਮੂਹ ਜਾਂ ਵਿਅਕਤੀ ਲਈ ਮਨੋਰੰਜਨ ਕੀ ਹੈ ਉਸਨੂੰ ਕੰਮ ਜਾਂ ਦੂਜੇ ਦੁਆਰਾ ਬੇਰਹਿਮੀ ਦਾ ਕੰਮ ਮੰਨਿਆ ਜਾ ਸਕਦਾ ਹੈ ਮਨੋਰੰਜਨ ਦੇ ਜਾਣੇ ਪਛਾਣੇ ਰੂਪਾਂ ਵਿੱਚ ਵੱਖ ਵੱਖ ਮੀਡੀਆ ਨੂੰ ਪਾਰ ਕਰਨ ਦੀ ਸਮਰੱਥਾ ਹੈ ਅਤੇ ਉਹਨਾਂ ਨੇ ਰਚਨਾਤਮਕ ਰੀਮਿਕਸ ਲਈ ਇੱਕ ਪ੍ਰਤੀਤ ਤੌਰ 'ਤੇ ਅਸੀਮਿਤ ਸੰਭਾਵਨਾਵਾਂ ਦਾ ਪ੍ਰਦਰਸ਼ਨ ਕੀਤਾ ਹੈ